ਪੰਜਾਬੀ ਭਾਸ਼ਾ ਇਸ ਖੇਤਰ ਵਿੱਚ ਇਸ ਖੇਤਰ ਦੀਆਂ ਹੋਰ ਭਾਸ਼ਾਵਾਂ ਨਾਲ ਵੀ ਮ ਮੇਲ ਖਾਂਦੀ ਹੈ ਜਿਵੇਂ ਕਿ ਹਿੰਦੀ ਇਹ ਪੰਜਾਬੀ ਭਾਸ਼ਾ ਹਿੰਦੀ ਨਾ ਹਿੰਦੀ ਭਾਸ਼ਾ ਨਾਲ ਸੰਬੰਧ ਰੱਖਦੀ ਹੈ ਸੰਬੰਧਿਤ ਹੈ ਜਿਵੇਂ ਕਿ ਪੰਜਾਬੀ ਦੇ ਕੁਛ ਅੱਖਰ ਹਨ ਜੋ ਹਿੰਦੀ ਨਾਲ ਸੰਬੰਧਿਤ ਹਿੰਦੀ ਵਿੱਚ ਵੀ ਸੇਮ ਹੀ ਅਰਥ ਹੈ ਉਸਦਾ ਜਿਵੇਂ ਕਿ ਘਰ ਅਨੁਸ਼ਾਸ਼ਨ ਵਿਦਿਆਰਥੀ ਅਧਿਆਪਕ ਮਾਤਾ ਪਿਤਾ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਅੱਖਰ ਹਨ ਜੋ ਕਿ ਹਿੰਦੀ ਅਤੇ ਪੰਜਾਬੀ ਦੇ ਸੇਮ ਹਨ ਇਹ ਆਪਸ ਵਿੱਚ ਸੰਬੰਧ ਰੱਖਦੇ ਹਨ ਦੋਵੇਂ ਭਾਸ਼ਾਵਾਂ ਇਹਨਾਂ ਵਿੱਚ ਕੁਛ ਜ਼ਿਆਦਾ ਅੰਤਰ ਨਹੀਂ ਹੈ ਪ ਪੰਜਾਬ ਵਿੱਚ ਇਸ ਖੇਤਰ ਵਿੱਚ ਦੋਵੇਂ ਹੀ ਭਾਸ਼ਾ ਬਹੁਤ ਜ਼ਿਆਦਾ ਬੋਲੀਆਂ ਜਾਂਦੀਆਂ ਹਨ ਅ ਪੰਜਾਬੀ ਵੀ ਉਨਾ ਹੀ ਪੰਜਾਬੀ ਨੂੰ ਜਿੰਨਾ ਲੋਕ ਮਾਣ ਦਿੰਦੇ ਹਨ ਉਨਾ ਹੀ ਹਿੰਦੀ ਨੂੰ ਦਿੰਦੇ